ਗਰੀਬੀ ਇੱਕ ਚੰਗੀ ਡਾਕਟਰੀ ਦੇਖਭਾਲ ਤੱਕ ਪਹੁੰਚਣ ਵਿੱਚ ਇੱਕ ਰੁਕਾਵਟ ਹੈ ਇਹ ਗੱਲ ਕਿਤੇ ਨਾ ਕਿਤੇ ਸਹੀ ਵੀ ਹੈ ਅਤੇ ਕਿਤੇ ਨਾ ਕਿਤੇ ਗ਼ਲਤ ਵੀ ਹੈ ਕਿਉਂਕਿ ਹਰ ਤਰ੍ਹਾਂ ਦੀ ਸਰਕਾਰ ਵੱਲੋਂ ਸਰਕਾਰੀ ਹਸਪਤਾਲ ਖੋਲ਼੍ਹੇ ਜਾਂਦੇ ਹਨ ਅਤੇ ਉਨ੍ਹਾਂ ਸਰਕਾਰੀ ਹਸਪਤਾਲਾਂ ਵਿੱਚ ਜਿਹੜੇ ਡਾਕਟਰ ਹੁੰਦੇ ਨੇ ਉਹ ਬਹੁਤ ਹੀ ਪੜ੍ਹੇ ਲਿਖੇ ਅਤੇ ਬੜੇ ਹੀ ਤਜਰਬੇਕਾਰ ਡਾਕਟਰ ਹੁੰਦੇ ਹਨ ਅਤੇ ਉਹ ਸਾਰੇ ਮਰੀਜ਼ਾਂ ਨੂੰ ਬੜੇ ਹੀ ਵਧੀਆ ਢੰਗ ਨਾਲ ਦੇਖਦੇ ਹਨ ਅਤੇ ਪਰ ਸਰਕਾਰੀ ਹਸਪਤਾਲਾਂ ਵਿੱਚ ਰਸ਼ ਬਹੁਤ ਜ਼ਿਆਦਾ ਹੋਣ ਕਰਕੇ ਉਨ੍ਹਾਂ ਕੋਲੋਂ ਕਈ ਵਾਰ ਮਰੀਜ਼ਾਂ ਨੂੰ ਚੰਗੀ ਤਰ੍ਹਾਂ ਨਹੀਂ ਦੇਖਿਆ ਜਾਂਦਾ ਅਤੇ ਉਨ੍ਹਾਂ ਦਾ ਸਟਾਫ਼ ਵੀ ਇਹ ਚੰਗੀ ਤਰ੍ਹਾਂ ਉਨ੍ਹਾਂ ਨੂੰ ਟ੍ਰੀ ਦੇਖ ਭਾਲ ਨਹੀਂ ਕਰ ਪਾਉਂਦਾ ਅਤੇ ਇਸ ਕਰਕੇ ਸਾਡੇ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਹਨ ਕਿ ਸਰਕਾਰੀ ਹਸਪਤਾਲਾਂ ਵਿੱਚ ਜਿਹੜੀ ਕੇਅਰ ਹੈ ਉਹ ਚੰਗੀ ਤਰ੍ਹਾਂ ਨਹੀਂ ਹੁੰਦੀ ਦੇਖ ਭਾਲ ਵਗੈਰਾ ਉਹ ਸਾਰੇ ਮਰੀਜ਼ਾਂ ਦੀ ਇੱਕੋ ਸਾਰ ਨਹੀਂ ਕਰਦੇ ਅਗਰ ਕਿਸੇ ਕੋਲ ਪੈਸਾ ਹੈ ਜਾਂ ਕਿਸੇ ਕੋਲ ਸਿਫ਼ਾਰਸ਼ ਤਰ੍ਹਾਂ ਦੀ ਕੋਈ ਚੀਜ਼ ਹੈ ਤਾਂ ਉਸ ਨੂੰ ਹੀ ਵਧੀਆ ਤਰੀਕੇ ਨਾਲ ਉੱਥੇ ਦੇਖਿਆ ਜਾਂਦਾ ਹੈ ਨਹੀਂ ਤਾਂ ਦੂਸਰੇ ਲੋਕਾਂ ਨੂੰ ਉਹ ਏਵੇਂ ਹੀ ਗੇੜੇ ਮਰਵਾਉਂਦੇ ਰਹਿੰਦੇ ਹਨ ਅੱਜ ਆ ਜਿਓ ਕੱਲ੍ਹ ਆ ਜਿਓ ਅੱਜ ਸਾਡੇ ਕੋਲ ਇਹ ਨਹੀਂ ਹੈ ਅਤੇ ਹੋਰ ਵੀ ਕਈ ਚੀਜ਼ਾਂ ਉਨ੍ਹਾਂ ਕੋਲ ਵੀ ਪੈਸੇ ਦੇ ਕਾਰਨ ਉਨ੍ਹਾਂ ਕੋਲ ਚੀਜ਼ਾਂ ਨਹੀਂ ਵੀ ਹੁੰਦੀਆਂ ਅਤੇ ਉਨ੍ਹਾਂ ਦੀ ਕੇਅਰ ਵੀ ਕੋਈ ਚੱਜ ਢੰਗ ਨਾਲ ਨਹੀਂ ਕਰਦਾ ਅਗਰ ਕੋਈ ਚੀਜ਼ ਟੁੱਟ ਗਈ ਹੈ ਤਾਂ ਉਹਨੂੰ ਟੁੱਟੀ ਹੀ ਰਹਿਣ ਦਿੰਦੇ ਆ ਉਸ ਤਰ੍ਹਾਂ ਹੀ ਉਹਨੂੰ ਕਰਦੇ ਰਹਿੰਦੇ ਹਾਂ ਅਤੇ ਦੂਜੀ ਗੱਲ ਅਗਰ ਸਾਨੂੰ ਪਿੰਡਾਂ ਤੱਕ ਇਹ ਸਰਕਾਰੀ ਸੁਵਿਧਾਵਾਂ ਡਾਕਟਰੀ ਪਹੁੰਚਾਣੀਆਂ ਹੋਣ ਤਾਂ ਸਾਨੂੰ ਸਾਰੇ ਜਗ੍ਹਾ 'ਤੇ ਇੱਕ ਇੱਕ ਡਿਸਪੈਂਸਰੀ ਖੋਲ੍ਹਣੀ ਚਾਹੀਦੀ ਹੈ ਜਿੱਥੇ ਕਿ ਹਰ ਇੱਕ ਆਮ ਨਾਗਰਿਕ ਪਹੁੰਚ ਸਕੇ ਅਤੇ ਉਨ੍ਹਾਂ ਡਿਸਪੈਂਸਰੀਆਂ ਵਿੱਚ ਇੱਕ ਐੱਮ ਬੀ ਬੀ ਐੱਸ ਡਾਕਟਰ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਐੱਮ ਬੀ ਬੀ ਐੱਸ ਡਾਕਟਰ ਜਿਹੜਾ ਹੁੰਦਾ ਹੈ ਉਹਨੂੰ ਸਾਰੇ ਤਰ੍ਹਾਂ ਦੀਆਂ ਬਿਮਾਰੀਆਂ ਦੀ ਨੋਲਜ ਹੁੰਦੀ ਹੈ ਅਤੇ ਉਹ ਅੱਗੇ ਫਿਰ ਕਿਸੇ ਨੂੰ ਹੋਰ ਹਸਪਤਾਲ ਵੀ ਭੇਜ ਸਕਦਾ ਹੈ ਜਿੱਥੇ ਉਸ ਕੋਲ ਡਿਸਪੈਂਸਰੀ ਵਿੱਚ ਇਲਾਜ ਨਾ ਹੋਵੇ